ਮੇਰਾ ਨਾਮ ਸੁਖਜੀਵਨ ਕੌਰ ਹੈ ਅਤੇ ਮੇਰਾ ਜਿਹੜਾ ਕੰਮ ਹੈ ਉਹ ਮੈਂ ਇੱਕ ਟੀਚਰ ਹਾਂ ਇੰਗਲਿਸ਼ ਦੀ ਅਧਿਆਪਕਾ ਹਾਂ ਅਤੇ ਮੇਰੀ ਜਿਹੜੀ ਕੁਆਲੀਫਿਕੇਸ਼ਨ ਹੈ ਮੈਂ ਬੀ ਏ ਕੀਤੀ ਹੈ ਬੈਚਲਰ ਔਫ਼ ਆਰਟਸ ਅਤੇ ਬੀ ਐੱਡ ਜੋ ਕਿ ਬੈਚਲਰ ਔਫ਼ ਐਜੂਕੇਸ਼ਨ ਔਰ ਉਹਦੇ ਵਿੱਚ ਮੇਰੇ ਦੋ ਵਿਸ਼ੇ ਸਨ ਇੱਕ ਵਿਸ਼ਾ ਸੀ ਇੰਗਲਿਸ਼ ਦਾ ਅਤੇ ਦੂਜਾ ਸੀ ਸਮਾਜਿਕ ਸਿੱਖਿਆ ਦਾ ਅਤੇ ਉਸ ਤੋਂ ਬਾਅਦ ਮੈਂ ਆਪਣੀ ਮਾਸਟਰਜ਼ ਕੀਤੀ ਹੈ ਜੋ ਕਿ ਮਾਸਟਰਜ਼ ਔਫ਼ ਆਰਟਸ ਇੰਨ ਪੋਲੀਟੀਕਲ ਸਾਇੰਸ ਅਤੇ ਮੈਂ ਸਾਰੀ ਆਪਣੀ ਵਿੱਦਿਆ ਚੰਡੀਗੜ੍ਹ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ ਹੈ ਅਤੇ ਹੁਣ ਮੈਂ ਐਜ਼ ਆ ਟੀਚਰ ਦਾ ਕੰਮ ਕਰਦੀ ਹਾਂ ਅਤੇ ਜਿਹੜਾ ਮੇਰੀ ਜੌਬ ਹੈ ਉਹ ਬਹੁਤ ਹੀ ਵਧੀਆ ਜੌਬ ਹੈ ਔਰ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਕਿਉਂਕਿ ਇਸ ਜੌਬ ਦੇ ਵਿੱਚ ਜਾ ਕੇ ਮੈਂ ਆਪਣੇ ਬੱਚਿਆਂ ਨਾਲ ਬਹੁਤ ਜ਼ਿਆਦਾ ਖੁਸ਼ ਹੁੰਦੀ ਹਾਂ ਜੇ ਮੈਨੂੰ ਕੋਈ ਵੀ ਪਰੇਸ਼ਾਨੀ ਹੁੰਦੀ ਹੈ ਜਾਂ ਕੋਈ ਵੀ ਤਕਲੀਫ਼ ਹੁੰਦੀ ਹੈ ਜਦੋਂ ਮੈਂ ਬੱਚਿਆਂ ਵਿੱਚ ਚਲੇ ਜਾਂਦੀ ਹਾਂ ਤਾਂ ਉਦੋਂ ਮੈਂ ਸਾਰੀਆਂ ਚਿੰਤਾਵਾਂ ਭੁੱਲ ਜਾਂਦੀ ਹਾਂ ਅਤੇ ਮੈਨੂੰ ਕੁਛ ਯਾਦ ਚੇਤੇ ਨਹੀਂ ਰਹਿੰਦਾ ਅਤੇ ਇਸਦੇ ਨਾਲ਼ ਮੈਂ ਬਹੁਤ ਜ਼ਿਆਦਾ ਬੀਜ਼ੀ ਰਹਿੰਦੀ ਹਾਂ ਅਤੇ ਮੇਰਾ ਟਾਈਮ ਮੈਨੂੰ ਖ਼ੁਦ ਨੂੰ ਨਹੀਂ ਪਤਾ ਚੱਲਦਾ ਕਿ ਮੇਰਾ ਟਾਈਮ ਕਦੋਂ ਨਿਕਲ ਜਾਂਦਾ ਹੈ